ਪੋਲਟਰੀ ਉਤਪਾਦਾਂ ਦੀ ਪ੍ਰੋਸੈਸਿੰਗ ਲਈ ਬਹੁਤ ਸਾਰੇ ਤਰੀਕੇ ਹਨ ਜਿਸ ਵਿੱਚ ਗੁਣਵਤਾ ਸੁਰੱਖਿਆ ਅਤੇ ਸਾਂਭ ਸੰਭਾਲ ਲ ਲਈ ਹੇਠ ਲਿਖੇ ਤਰੀਕੇ ਹਨ

ਕਤਲ ਦੋ ਤਰੀਕੇ ਨਾਲ ਹੁੰਦਾ ਇੱਕ ਝਟਕਾ ਇੱਕ ਹਲਾਲ ਸਹੀ ਤਰੀਕੇ ਨਾਲ ਕਤਲ ਕੀਤੇ ਹੋਏ ਦੀ ਗੁਣਵਤਾ ਉਚਿਤ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਖੂਨ ਕੱਢਣਾ ਇਹ ਤਰੀਕਾ ਮਾਸ ਦੇ ਰੰਗ ਸਵਾਦ ਅਤੇ ਉਸਦੀ ਲਾਈਫ ਨਾਲ ਸੰਬੰਧਿਤ ਹੁੰਦਾ ਹੈ ਬਚਾਅ ਮੀਟ ਨੂੰ ਬੈਕਟੀਰੀਆ ਰਹਿਤ ਰੱਖਣ ਵਾਸਤੇ ਉਸਨੂੰ ਡੀਪ ਫਰੇਜ਼ਰ ਵਿੱਚ ਜੀਰੋ ਤੋਂ ਚਾਰ ਡਿਗਰੀ ਤੱਕ ਰੱਖਿਆ ਜਾਣਾ ਚਾਹੀਦਾ ਹੈ ਰਸਾਇਣਿਕ ਸੰਭਾਲ ਇਸ ਨੂੰ ਨਾਈਟ੍ਰੇਸ਼ਨ ਨੂੰ ਵਧਾਉਣ ਲਈ ਨਾਈਟਰੇਸ਼ਨ ਵਧਾਉਣ ਲਈ ਇਸ ਨੂੰ ਸਾਫ ਸਫਾਈ ਕੀਤੀ ਜਾਂਦੀ ਹੈ ਚਮੜੀ ਨੂੰ ਹਟਾਉਣਾ ਅਤੇ ਧੋਣਾ ਬਹੁਤ ਪ੍ਰੋਸੈਸ ਪ੍ਰੋਸੈਸਿੰਗ ਵਾਲਾ ਸਿਸਟਮ ਹੈ ਕਟਿੰਗ ਅਤੇ ਪੈਕਿੰਗ ਕੱਟ ਕੇ ਇਸ ਨੂੰ ਅਲੱਗ ਅਲੱਗ ਪਾਰਟਸ ਵਿੱਚ ਰੱਖਿਆ ਜਾਂਦਾ ਹੈ ਲੈਗ ਪੀਸ ਅਲੱਗ ਛਾਤੀ ਅਲੱਗ ਗਰਦਨ ਅਲੱਗ ਅਲੱਗ ਕਰਕੇ ਪੈਕ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਮੇਂ ਸਮੇਂ 'ਤੇ ਟੈਸਟਿੰਗ ਵੀ ਕਰਵਾਈ ਜਾਣੀ ਚਾ ਚਾਹੀਦੀ ਹੈ